ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਮੀਨ ਕੌਰ ਹੈ ਸਰ ਮੈਂ ਦਿੱਲੀ ਦੀ ਰਹਿਣ ਵਾਲੀ ਹਾਂ ਐਕਚੁਲੀ ਸਰ ਮੈਂ ਨਾ ਗੁਰਦੁਆਰੇ ਘੁੰਮਣ ਆਉਣਾ ਚਾਹੁੰਦੀ ਹਾਂ ਮਤਲਬ ਮੈਂ ਗੁਰਦੁਆਰਾ ਸਾਹਿਬ ਵੇਖਣਾ ਚਾਹੁੰਦੀ ਹਾਂ ਅਤੇ ਉੱਥੇ ਮਤਲਬ ਜਿਹੜਾ ਲੰਗਰ ਹੁੰਦਾ ਨਾ ਉੱਥੇ ਜੋ ਕੁਝ ਸੇਵਾ ਹੁੰਦੀ ਹੈ ਮਤਲਬ ਮੈਂ ਵੀ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਹਾਂ ਅਤੇ ਤੁਸੀਂ ਉਹਦੇ ਬਾਰੇ ਮੈਨੂੰ ਕੁਛ ਦੱਸੋਗੇ ਮਤਲਬ ਜਿਹੜਾ ਲੋਕ ਤੁਸੀਂ ਆਪ ਦੱਸ ਦਿਉ ਜਿਹੜਾ ਜ਼ਿਆਦਾ ਵਧੀਆ ਰਹੂਗਾ ਮੈਂ ਉਹੀ ਕਰ ਦੁੰਗੀ ਜਿਵੇਂ ਰੋਟੀ ਦਾ ਲੰਗਰ ਲਾ ਸਕਦੇ ਹਾਂ ਆਪਾਂ ਠੀਕ ਹੈ ਜੇ ਪਰ ਜੇ ਮੈਂ ਗੁਰਦੁਆਰੇ 'ਚ ਪੈਸੇ ਪਹੁੰਚਾ ਦਾ ਅਤੇ ਗੁਰਦੁਆਰੇ ਵਾਲੇ ਆਪੇ ਲਿਆਉਣ ਸਮਾਨ ਅਤੇ ਫਿਰ ਪੇਮੈਂਟ ਦਾ ਕੀ ਮੈਥਡ ਅਤੇ ਪੇਮੈਂਟ ਦਾ ਕੀ ਉਹ ਰੋਲ ਰਹੂਗਾ ਕਿਵੇਂ ਕਰ ਸਕਦੀ ਹਾਂ ਮੈਂ ਤੁਹਾਨੂੰ ਅੱਛਾ ਤੁਸੀਂ ਮਤਲਬ ਮੈਂ ਚਾਹੇ ਆ ਕੇ ਵੀ ਤੁਹਾਨੂੰ ਪੈਸੇ ਫੜਾ ਦਾਂ ਚਾਹੇ ਉੱਧਰ ਪੇਮੈਂਟ ਕਰ ਦਾਂ ਇਹ ਮੇਰੀ ਇੱਛਾ ਅਤੇ ਲੰਗਰ ਵੀ ਮੈਂ ਜਿਵੇਂ ਮਰਜ਼ੀ ਦਾ ਕਰਾ ਸਕਦੀ ਹਾਂ ਅੱਛਾ ਜੀ ਅਤੇ ਫਿਰ ਮਤਲਬ ਜਿੰਨਾ ਜਿੰਨਾ ਟਾਈਮ ਮੈਂ ਉੱਥੇ ਆਵਾਂਗੀ ਤੁਸੀਂ ਲੰਗਰ ਵਗੈਰਾ ਦੀ ਜੇ ਤੁਸੀਂ ਤਿਆਰੀ ਰੱਖੋ ਮੈਂ ਤੁਹਾਨੂੰ ਸਾਰਾ ਪੈਸਾ ਪਹਿਲਾਂ ਹੀ ਫੋਨ 'ਤੇ ਪਾ ਦਾਂ ਅਤੇ ਤੁਸੀਂ ਉੱਥੇ ਤਿਆਰੀ ਕਰਾ ਦਿਓ ਫਿਰ ਮੈਂ ਲੰਗਰ ਵਾਲੇ ਦਿਨ ਹੀ ਜੇ ਆ ਜਾ ਅੱਛਾ ਜੀ ਠੀਕ ਠੀਕ ਹੈ ਠੀਕ ਹੈ ਸਰ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਬਾ ਮਿਹਰ ਕਰੇ